ਹੈਲੋਂ ਓ ਸਤਿ ਸ਼੍ਰੀ ਅਕਾਲ ਬਾਈ ਐਮਾਜੋਨ ਐਪ ਤੋਂ ਬੋਲਦੇ ਹੋ ਬਈ ਬਈ ਮੈਂ ਬੱਲੂਆਣੇ ਪਿੰਡ ਤੋਂ ਬੋਲਦੀ ਹਾਂ ਬਈ ਮੈਂ ਇੱਕ ਨਾ ਪੰਜ ਕੁ ਦਿਨ ਪਹਿਲਾਂ ਇੱਕ ਬੈਗ ਮੰਗਾਇਆ ਸੀ ਜਿਹੜਾ ਕਿ ਬਹੁਤ ਹੀ ਜ਼ਿਆਦਾ ਸੋਹਣਾ ਸੀ ਅਤੇ ਉਹਦੇ ਉੱਪਰ ਜਿਹੜਾ ਕਵਰ ਕੀਤਾ ਸੀ ਉਹ ਵੀ ਬਹੁਤ ਜ਼ਿਆਦਾ ਸੋਹਣਾ ਸੀ ਮੈਨੂੰ ਦੇ ਦੇਖਦੇ ਹੀ ਬਾਲਾ ਸੋਹਣਾ ਲੱਗਿਆ ਗਿਆ ਖੋਲ੍ਹਣ ਤੋਂ ਪਹਿਲਾਂ ਹੀ ਸੋਹਣਾ ਲੱਗਿਆ ਜਦੋਂ ਉਹ ਮੈਨੂੰ ਡਿਰੀਵਰੀ ਵਾਲੇ ਫੜਾ ਕੇ ਗਏ ਤਾਂ ਕਰਕੇ ਬਈ ਮੈਨੂੰ ਉਹਨਾਂ ਨੇ ਕਿਹਾ ਸੀ ਕਿ ਸੱਤ ਦਿਨਾਂ ਵਿੱਚ ਆਉਗਾ ਪਰ ਉਹ ਚਾਰ ਦਿਨਾਂ ਵਿੱਚ ਹੀ ਮੇਰੇ ਕੋਲ ਪਹੁੰਚ ਗਿਆ ਸੀ ਬਈ ਅਤੇ ਵੈਸੇ ਵੀ ਬਹੁਤ ਜ਼ਿਆਦਾ ਸੋਹਣਾ ਸੀਗਾ ਅਤੇ ਬੈ ਮੇਰੀ ਮੇਰੀ ਸਿਸਟਰ ਲਈ ਮੰਗਾਇਆ ਸੀ ਮੈਂ ਉਹਦਾ ਬਰਡੇ ਸੀ ਮੈਂ ਉਹਨੂੰ ਗਿਫਟ ਕਰਨਾ ਸੀ ਪਰ ਮੈਨੂੰ ਵੀ ਆਏਂ ਸੀ ਕਿ ਜਲਦੀ ਤੋਂ ਜਲਦੀ ਆ ਜਾਏ ਟੈਮ ਤਾਂ ਉਹਨਾਂ ਨੇ ਮੈਨੂੰ ਸੱਤ ਦਿਨਾਂ ਦਾ ਦਿੱਤਾ ਸੀ ਪਰ ਪਹੁੰਚ ਮੇਰੇ ਕੋਲ ਚਾਰ ਦਿਨ ਹੀ ਗਿਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ

ਅਤੇ ਓਨਲੀ ਮੈਂ ਮੇਰੇ ਫਰੈਂਡ ਹੋਣਾਂ ਨੂੰ ਵੀ ਇਹੀ ਗੱਲ ਕਹਿੰਦੀ ਹਾਂ ਕਿ ਸਾਰੇ ਜਾਣੇ ਤੁਹਾਡੇ ਐਨਮਾਜੋਨ ਐਪ ਤੋਂ ਹੀ ਦੇਖ ਕੇ ਲੈ ਲੈਣ ਕਿਉਂਕਿ ਬਜ਼ਾਰ ਜਾਂਦੇ ਹਾਂ ਤਾਂ ਉੱਥੇ ਬਹੁਤ ਜ਼ਿਆਦਾ ਮਹਿੰਗੀ ਚੀਜ਼ ਮਿਲਦੀ ਹੈ ਇੱਥੇ ਸਸਤੀ ਵੀ ਆ ਅਤੇ ਜ ਮਿਲ ਵੀ ਜਲਦੀ ਜਾਂਦੀ ਆ ਅਤੇ ਹੈ ਵੀ ਬਹੁਤ ਜ਼ਿਆਦਾ ਵਧੀਆ ਅਤੇ ਮੈਂ ਮੇਰੀ ਸਿਸਟਰ ਨੂੰ ਜਦੋਂ ਗਿਫਟ ਕੀਤਾ ਉਹਨੇ ਖੋਲ੍ਹਿਆ ਤਾਂ ਉਹਨੂੰ ਵੀ ਬਹੁਤ ਜ਼ਿਆਦਾ ਵਧੀਆ ਲੱਗਿਆ ਬਈ ਇਸ ਇਸ ਲਈ ਮੈਂ ਆਹ ਸੋ ਹਰ ਇੱਕ ਚੀਜ਼ ਤੁਹਾਡੇ ਤੋਂ ਹੀ ਐਮਾਜੋਨ ਐਪ ਤੋਂ ਹੀ ਮੰਗਵਾਊਗੀ ਧੰਨਵਾਦ ਬਈ